ਮੈਂ ਆਨਲਾਈਨ ਫਲਿਪਕਾਰਟ ਐਮਾਜਨ ਬਹੁਤ ਸਾਰੇ ਐਪਾਂ ਤੋਂ ਇਅਰਬਡਸ ਦੀ ਜੋੜੀ ਮੰਗਵਾਈ ਪਰ ਮੈਂ ਅੰਤ ਦੇ ਵਿੱਚ ਇੱਕ ਹੋਰ ਐਪ ਤੋਂ ਇਅਰਬਡਸ ਦੀ ਜੋੜੀ ਮੰਗਵਾਈ ਜਿਹਨਾਂ ਦੀ ਆਵਾਜ਼ ਦੀ ਗੁਣਵੱਤਾ ਵੀ ਬਹੁਤ ਵਧੀਆ ਸੀ ਇਹ ਇੱਕ ਤਾਂ ਮੈਨੂੰ ਬਹੁਤ ਘੱਟ ਕੀਮਤ 'ਤੇ ਵਧੀਆ ਤਰੀਕੇ ਨਾਲ ਮਿਲ ਗਏ ਅਤੇ ਇਹਨਾਂ ਦੇ ਪਹੁੰਚਣ ਦੇ ਥੋੜ੍ਹਾ ਮਤਲਬ ਮੰਗਵਾਉਣ ਦੇ ਥੋੜ੍ਹੇ ਦਿਨਾਂ ਬਾਅਦ ਹੀ ਇਹ ਮੈਨੂੰ ਪ੍ਰਾਪਤ ਹੋ ਗਏ ਇਹਨਾਂ ਵਿੱਚ ਆਵਾਜ਼ ਦੀ ਗੁਣਵੱਤਾ ਵੀ ਬਹੁਤ ਵਧੀਆ ਹੈ ਇਹਨਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਚਲਦੇ ਚਲਦੇ ਇਹਨਾਂ ਵਿੱਚ ਕੋਈ ਵੀ ਰੁਕਾਵਟ ਨਹੀਂ ਆਉਂਦੀ ਜੋ ਕਿ ਘਰ ਵਿੱਚ ਮੇਰੇ ਸਾਰਿਆਂ ਦੁਆਰਾ ਪਸੰਦ ਕੀਤੇ ਗਏ ਔਰ ਇਸ ਦੇ ਨਾਲ ਹੀ ਇਹ ਬਹੁਤ ਹੀ ਵਧੀਆ ਸੁਵਿਧਾਵਾਂ ਵੀ ਪ੍ਰਦਾਨ ਕਰਦੇ ਹਨ